ਮੇਰੇ ਅਨੁਸਾਰ ਭੰਗੜਾ ਫਿਟਨਸ ਲਈ ਬਹੁਤ ਜ਼ਰੂਰੀ ਮਤਲਬ ਕਿ ਬਹੁਤ ਸਹੀ ਹੈ ਕਿਉਂਕਿ ਭੰਗੜਾ ਪਾਉਣ ਦੇ ਨਾਲ ਜਦੋਂ ਅਸੀਂ ਤੇਜ਼ ਤੇਜ਼ ਤੇਜ਼ ਮਤਲਬ ਤਾਲ ਨਾਲ ਨੱਚਦੇ ਹਾਂ ਤਾਂ ਇਸ ਤਰ੍ਹਾਂ ਲੱਗਦਾ ਕਿ ਸਰੀਰ ਦੇ ਵਿੱਚ ਬੜੀ ਫੁਰਤੀ ਆ ਗਈ ਹੈ ਅਤੇ ਇਸ ਨਾਲ ਸਰੀਰ ਹੈ ਜਿਹੜਾ ਉਹ ਸਾਡੀਆਂ ਅੰਦਰੂਨੀ ਮਤਲਬ ਜਿਹੜੀਆਂ ਅੰਦਰੂਨੀ ਤਾਕਤਾਂ ਆ ਉਹਨਾਂ ਨੂੰ ਵੀ ਕੰਟਰੋਲ 'ਚ ਕਰਦਾ ਮੈਨੂੰ ਤਾਂ ਇੱਦਾਂ ਲੱਗਦਾ ਕਿ ਜਦੋਂ ਕਦੇ ਅਸੀਂ ਹੌਲੀ ਸਟੈਪ ਚੱਕਦੇ ਹਾਂ ਕਦੇ ਤੇਜ਼ ਸਟੈਪ ਚੱਕਦੇ ਹਾਂ ਤਾਂ ਉਹਦੇ ਨਾਲ ਫਿਟਨਸ ਆਉਂਦੀ ਹੈ ਸਰੀਰ ਦੇ ਵਿੱਚ ਅਤੇ ਉਹਨੂੰ ਭੰਗੜਾ ਤਾਂ ਅੱਜ ਕੱਲ੍ਹ ਕਿਸੇ ਕੋਲ ਟਾਈਮ ਹੀ ਨਹੀਂ ਹੈਗਾ ਆਪਣੇ ਸਰੀਰ ਨੂੰ ਦੇਖਣ ਲਈ ਪਰ ਜਦੋਂ ਸਾਨੂੰ ਮੌਕਾ ਮਿਲਦਾ ਕੋਈ ਖੁਸ਼ੀ ਦਾ ਮੌਕਾ ਮਿਲਦਾ ਅਤੇ ਫਿਰ ਅਸੀਂ ਡਾਂਸ ਕਰਦੇ ਹਾਂ ਅਤੇ ਉਹਦੇ ਵਿੱਚ ਸਾਨੂੰ ਲੱਗਦਾ ਕਿ ਭੰਗੜਾ ਪਾਉਣ ਦੇ ਨਾਲ ਸਾਡੇ ਸਰੀਰ ਦੀ ਇੱਕ ਕਸਰਤ ਵੀ ਹੋ ਜਾਂਦੀ ਹੈ ਖੁਸ਼ੀ ਵੀ ਮਿਲ ਜਾਂਦੀ ਹੈ ਉਸ ਵੇਲੇ ਐਂ ਲੱਗਦਾ ਜਦੋਂ ਭੰਗੜਾ ਪਾਉਂਦੇ ਹਾਂ ਤਾਂ ਸਾਨੂੰ ਲੱਗਦਾ ਕਿ ਜਿਸ ਤਰ੍ਹਾਂ ਅਸੀਂ ਮਤਲਬ ਸਭ ਕੁਝ ਭੁੱਲ ਗਏ ਹਾਂ ਅਤੇ ਆਪਣੇ ਆਪ ਨੂੰ ਲੱਗਦੇ ਹਾਂ ਕਿ ਅਸੀਂ ਬਹੁਤ ਤੰਦਰੁਸਤ ਹਾਂ ਕਿਉਂਕਿ ਇਹਦੇ ਨਾਲ ਸਮੁੱਚੇ ਤੌਰ 'ਤੇ ਸਰੀਰ ਦੀ ਕਸਰਤ ਹੁੰਦੀ ਹੈ ਵੱਖ ਵੱਖ ਆਪਣੇ ਹਾਉ ਭਾਉ ਆਪਾਂ ਲੋਕਾਂ ਦੇ ਸਾਹਮਣੇ ਪੇਸ਼ ਕਰਦੇ ਹਾਂ ਖੁਸ਼ੀ ਦੇ ਦੂਸਰੇ ਬੰਦੇ ਨੂੰ ਵੀ ਲੱਗਦਾ ਕਿ ਹਾਂਜੀ ਕੋਈ ਆ ਸਾਨੂੰ ਆਪਣੇ ਦਿਲ ਦੀ ਗੱਲ ਦੱਸ ਰਿਹਾ ਅਤੇ ਮੈਨੂੰ ਲੱਗਦਾ ਕਿ ਇਹ ਇੱਕ ਖੁਸ਼ੀ ਦਾ ਪ੍ਰਗਟਾਵਾ ਹੈ ਅਤੇ ਵਰਤਮਾਨ ਵਿੱਚ ਹੁਣ ਤਾਂ ਹਰ ਕੋਈ ਮਤਲਬ ਭੰਗੜੇ ਨੂੰ ਬਹੁਤ ਜ਼ਿਆਦਾ ਪਰੈਫਰਸ ਦਿੰਦਾ ਹੈ ਅਤੇ ਲੱਗਦਾ ਕਿ ਭੰਗੜਾ ਬਹੁਤ ਜ਼ਿਆਦਾ ਉਤਸ਼ਾਹਿਤ ਕਰਨ ਵਾਲਾ ਇੱਕ ਨਾਚ ਲੋਕ ਨਾਚ ਹੈਗਾ